ਮੈਂ ਜਦ ਵੀ ਕੋਈ ਕਿਰਦਾਰ ਆਪਣੀ ਕਿਸੇ ਕਵਿਤਾ ਜਾਂ ਆਪਣੀ ਕਹਾਣੀ ਵਿੱਚ ਲੈਂਦਾ ਹਾਂ ਤਾਂ ਉਹਦਾ ਮੂਲ ਆਧਾਰ ਮੈਂ ਖੁਦ ਹੀ ਹੁੰਦਾ ਹਾਂ ਸਾਰੀ ਚਰਚਾ ਮੈਂ ਆਪਣੇ ਆਪ 'ਤੇ ਫੋਕਸ ਕਰਕੇ ਕਰ ਰਿਹਾ ਹੁੰਦਾ ਹਾਂ ਮੈਂ ਜੋ ਕੁਝ ਵੀ ਲਿਖਦਾ ਹਾਂ ਜ਼ਿਆਦਾਤਰ ਜਜ਼ਬਾਤਾਂ ਦੀ ਖੇਡ ਹੁੰਦੀ ਹੈ ਜਿੱਥੋਂ ਤੱਕ ਸਵਾਲ ਸਮਾਜ ਬਾਰੇ ਕੁਝ ਗਲਤ ਬੋਲਣ ਦਾ ਮਨੁੱਖਾਂ ਬਾਰੇ ਕੁਝ ਗਲਤ ਜਾਂ ਅਪਮਾਨ ਜਣ ਜਨਕ ਗੱਲਾਂ ਕਰਨ ਦਾ ਹੈ ਅਜਿਹੀਆਂ ਗੱਲਾਂ ਲਿਖਣ ਦਾ ਕੋਈ ਤੁੱਕ ਹੀ ਨਹੀਂ ਬਣਦਾ ਅਤੇ ਨਾ ਮੈਂ ਅੱਜ ਤੱਕ ਕਦੀ ਅਜਿਹੀਆਂ ਗੱਲਾਂ ਦਾ ਇਸਤੇਮਾਲ ਕੀਤਾ ਹੈ ਮੈਂ ਹਮੇਸ਼ਾ ਜਜ਼ਬਾਤੀ ਮਸਲਿਆਂ ਨੂੰ ਹੀ ਆਪਣੀ ਕਲਮ ਦੇ ਨਾਲ ਉਲੀਕਿਆ ਹੈ ਅਤੇ ਅੱਗੇ ਵੀ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਮੈਂ ਜੋ ਵੀ ਲਿਖਾਂ ਉਦੋਂ ਉਹਦੇ ਤੋਂ ਕੁਛ ਨਾ ਕੁਛ ਪੜ੍ਹਨ ਵਾਲੇ ਨੂੰ ਪ੍ਰੇਰਨਾ ਮਿਲੇ ਤਾਂ ਕਿ ਉਹ ਆਪਣੀ ਸ਼ਖਸੀਅਤ ਵਿੱਚ ਸੁਧਾਰ ਕਰ ਸਕੇ ਅਤੇ ਮੇਰੇ ਕਰੈਕਟਰ ਨੂੰ ਅਪਣਾ ਕੇ ਆਪਣੇ ਕਰੈਕਟਰ ਨੂੰ ਵਧੀਆ ਬਣਾ ਸਕੇ